ਪਹਿਲੇ ਸਮੇਂ ਵਿੱਚ ਪਸ਼ੂਆਂ ਨੂੰ ਚਰਾਉਣ ਲਈ ਹਰੇ ਮੈਦਾਨ ਉਪਲਬਧ ਸਨ ਪਸ਼ੂਆਂ ਨੂੰ ਚਰਾਉਣ ਲਈ ਸਾਰੇ ਜਿਨ੍ਹਾਂ ਦੇ ਵੀ ਘਰ ਪਸ਼ੂਆਂ ਹੁੰਦੀਆਂ ਸਨ ਉਹ ਉਹਨਾਂ ਨੂੰ ਚਰਾਉਣ ਲਈ ਮੈਦਾਨਾਂ ਵਿੱਚ ਖੇਤਾਂ ਵਿੱਚ ਲੈ ਜਾਂਦੇ ਸਨ ਜਿੱਥੇ ਉਹ ਜਿੱਦਾਂ ਕਿ ਉਹਨਾਂ ਨੂੰ ਹਰੇ ਘਾਹ ਖਾਣ ਨੂੰ ਮਿਲਣ ਹੁਣ ਇਸ ਸਮੇਂ ਵਿੱਚ ਪਸ਼ੂਆਂ ਨੂੰ ਘੱਟ ਹ ਘੱਟ ਹਰੇ ਘਾਹ ਖਾਣ ਨੂੰ ਮਿਲਦੇ ਹਨ ਇਸ ਦਾ ਕਾਰਨ ਇਹ ਹੈ ਕਿ ਮੈਦਾਨਾਂ ਵਿੱਚ ਦਵਾਈਆਂ ਦਾ ਛਿੜਕਾਓ ਵਾਯੂ ਪ੍ਰਦੂਸ਼ਣ ਪਾਣੀ ਦੀ ਕਮੀ ਕਾਰਨ ਘਾਹ ਘੱਟ ਹੁੰਦੇ ਹਨ ਦਵਾਈਆਂ ਦੇ ਛਿੜਕਾਓ ਕਾਰਨ ਘਾਹ ਸੁੱਕ ਜਾਂਦੇ ਹਨ ਅਤੇ ਪਾਣੀ ਦੀ ਕਮੀ ਨਾਲ ਘਾਹ ਵੀ ਨਹੀਂ ਹੁੰਦੇ ਅਤੇ ਇਸ ਨਾਲ ਪਸ਼ੂਆਂ 'ਤੇ ਹੁਣ ਕਾਫੀ ਜ਼ਿਆਦਾ ਅਸਰ ਪੈਂਦਾ ਹੈ ਉਹਨਾਂ ਨੂੰ ਘਾਹ ਹਰੇ ਘਾਹ ਨਹੀਂ ਖਾਣ ਨੂੰ ਮਿਲਦੇ ਉਹਨਾਂ 'ਤੇ ਪਸ਼ੂਆਂ 'ਤੇ ਜ਼ਿਆਦਾ ਪ੍ਰਭਾਵ ਪੈਂਦਾ ਉਹਨਾਂ ਦੀ ਸਿਹਤ ਵੀ ਖਰਾਬ ਹੋ ਜਾਂਦੀ ਹੈ ਅਤੇ ਤਾਂ ਕਿ ਉਹ ਸਹੀ ਪੋਸ਼ਣ ਨਾ ਮਿਲਣ ਕਾਰਨ ਉਨ੍ਹਾਂ ਉਹ ਮਰ ਵੀ ਜਾਂਦੇ ਹਨ ਅਤੇ ਉਹਨਾਂ ਦੀ ਸ ਠੀਕ ਦੇਖ ਭਾਲ ਨਾ ਹੋਣ ਕਾਰਨ ਉਹਨਾਂ ਨੂੰ ਇੱਦੀ ਛੱਡ ਦਿੱਤਾ ਜਾਂਦਾ ਹੈ ਤਾਂ ਕਿ ਉਹ ਇੱਦੀ ਮਤਲਬ ਕਿ ਘੁੰਮਦੇ ਰਹਿੰਦੇ ਹਨ ਜਿੱਥੇ ਮਰਜ਼ੀ ਉਹਨਾਂ ਨੂੰ ਜੋ ਮਿਲਦਾ ਖਾਣ ਨੂੰ ਉਹ ਖਾ ਲੈਂਦੇ ਹਨ ਪਲਾਸਟਿਕ ਆਦਿ ਹੋਰ ਵੀ ਕੁਛ ਹੁੰਦਾ ਹੈ ਉਹ ਖਾ ਲੈਂਦੇ ਉਹਦੇ ਨਾਲ ਉਹਨਾਂ ਦੇ ਸਰੀਰ ਵਿੱਚ ਜਾਂਦਾ ਅਤੇ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ